ਪੰਜਾਬੀ ਅਤੇ ਗੈਰ ਪੰਜਾਬੀ ਸਮਕਾਲੀ ਭਾਰਤੀ ਲੇਖਕ ਬਹੁਤ ਹਨ ਜਿਹਨਾਂ ਤੋਂ ਸਾਨੂੰ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ ਜਿਹਨਾਂ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਕਿਸੇ ਜਗ੍ਹਾ 'ਤੇ ਕਿੱਦਾਂ ਦੀ ਲਿਖਤ ਹੋ ਸਕਦੀ ਹੈ ਕਿਸੇ ਜਗ੍ਹਾ ਦਾ ਕਲਚਰ ਕਿੱਦਾਂ ਦਾ ਹੋ ਸਕਦਾ ਉੱਥੋਂ ਦਾ ਰਹਿਣ ਸਹਿਣ ਕਿੱਦਾਂ ਦਾ ਹੋ ਸਕਦਾ ਨਾਨਕ ਸਿੰਘ ਪੰਜਾਬੀ ਲੇਖਕ ਹਨ ਜਿਹਨਾਂ ਨੇ ਪੰਜਾਬ ਦੇ ਉਹ ਦ੍ਰਿਸ਼ ਨੂੰ ਦਰਸਾਇਆ ਹੋਇਆ ਜੋ ਦ੍ਰਿਸ਼ ਸ਼ਾਇਦ ਕਿਤੇ ਲੁਕਿਆ ਹੀ ਰਹਿ ਗਿਆ ਸੀ ਸ਼ੇਖ ਫਰੀਦ ਜੀ ਵੀ ਇੱਕ ਲੇਖਕ ਹੀ ਹੋਏ ਹਨ ਜਿਹਨਾਂ ਦੀਆਂ ਕਈ ਤੁਕਾਂ ਅਤੇ ਕਈ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹਨ ਕਈ ਲੇਖਕ ਇੱਦਾਂ ਦੇ ਵੀ ਹੋਏ ਹਨ ਜਿੱਦਾਂ ਇੱਕ ਸੰਤ ਹਨ ਉਹਨਾਂ ਦੀ ਇਕ ਕਿਤਾਬ ਹੈ ਜਿਹਦੇ ਵਿੱਚ ਗਿਆਨ ਇਹ ਦਿੱਤਾ ਹੋਇਆ ਕਿ ਜੀਵਨ ਨੂੰ ਜੀਣਾ ਕਿਵੇਂ ਹੈ ਉਹ ਪੰਜਾਬ ਦੇ ਲੇਖਕ ਨਹੀਂ ਹਨ ਉਹ ਬਾਹਰ ਦੇ ਲੇਖਕ ਹਨ ਪਰ ਕਿਤੇ ਨਾ ਕਿਤੇ ਜਾ ਕੇ ਅਖੀਰ ਦੇ ਵਿੱਚ ਇਹੀ ਸਿੱਟਾ ਨਿਕਲਦਾ ਹੈ ਕਿ ਜੀਵਨ ਜਾਚ ਜੋ ਆਪਾਂ ਨੂੰ ਸਿੱਖਣੀ ਚਾਹੀਦੀ ਹੈ ਉਹ ਕੀ ਹੈ ਉਹ ਪੰਜਾਬ ਦਾ ਲੇਖਕ ਵੀ ਸ਼ਾਇਦ ਉਹੀ ਦੱਸੇਗਾ ਜੋ ਕੋਈ ਬਾਹਰ ਦਾ ਲੇਖਕ ਦੱਸੇਗਾ ਇਹ ਅਸੀਂ ਕਿਵੇਂ ਸਮਝਦੇ ਹਾਂ ਆਪਣੇ ਜੀਵਨ 'ਚ ਕਿੱਦਾਂ ਅਪਣਾਉਂਦੇ ਹਾਂ ਇਹ ਸਾਡੇ 'ਤੇ ਹੈ